ਜਦੋਂ ਆਪਾਂ ਨਵਾਂ ਘਰ ਤਿਆਰ ਕਰਦੇ ਹਾਂ ਤਾਂ ਉਸ ਵਿੱਚ ਬਹੁਤ ਹੀ ਪੁਰਾਣਾ ਸਮਾਨ ਮਲਵਾ ਬਹੁਤ ਜ਼ਿਆਦਾ ਇੱਦਾਂ ਦਾ ਸਮਾਨ ਹੋ ਜਾਂਦਾ ਜਿਹੜਾ ਆਪਾਂ ਨੂੰ ਕੂੜੇ ਵਾਲੇ ਨੂੰ ਚੁਕਾਉਣਾ ਪੈਂਦਾ ਹੈ ਇਸ ਲਈ ਅਸੀਂ ਵੀ ਹੁਣੇ ਹੁਣ ਘਰ ਨਵਾਂ ਘਰ ਦੀ ਮੁਰੰਮਤ ਕੀਤੀ ਹੈ ਘਰ ਨੂੰ ਨਵਾਂ ਬਣਾਇਆ ਹੈ ਜਿਸ ਵਿੱਚ ਪੁਰਾਣਾ ਫਰਨੀਚਰ ਹੋਰ ਬਹੁਤ ਕੁਛ ਸੀ ਜੋ ਕੂੜੇ ਵਾਲੇ ਨੂੰ ਦੇਣ ਵਾਲਾ ਸੀ ਮੈਂ ਫਿਰ ਸੋਚਿਆ ਵੀ ਮੈਂ ਕੂੜੇ ਵਾਲੇ ਨੂੰ ਕਾਲ ਕਰਕੇ ਉਸ ਤੋਂ ਸਮਾਂ ਪਤਾ ਕਰਾਂ ਵੀ ਕਿੰਨੀ ਦੇਰ ਤੱਕ ਉਹ ਆਉਂਦੇ ਨੇ ਕਿ ਜਦਕਿ ਮੈਂ ਸਕੁ ਦੇਣ ਵਾਲੇ ਕੂੜੇ ਨੂੰ ਇਕੱਠਾ ਕਰਕੇ ਰੱਖ ਸਕਾਂ ਫਿਰ ਮੈਂ ਕੂੜੇ ਵਾਲੇ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਗਿਆਰ੍ਹਾਂ ਵਜੇ ਸੁਬਹਾ ਆ ਜਾਵਾਂਗੇ ਤਾਂ ਮੈਂ ਸੁਬਹਾ ਤੋਂ ਹੀ ਲੱਗ ਗਈ ਸੀ ਜੋ ਪੁਰਾਣਾ ਫਰਨੀਚਰ ਸੀ ਹੋਰ ਘਰਦਾ ਸਮ ਟੁੱਟਿਆ ਹੋਇਆ ਸਮਾਨ ਸੀ ਜੋ ਕੂੜੇ ਵਾਲੇ ਨੂੰ ਦੇਣ ਵਾਲਾ ਸੀ ਹੋਰ ਮਲਬਾ ਸੀ ਵੀ ਹੋਰ ਜੋ ਵੀ ਕੂੜਾ ਕੰਕਰ ਸੀ ਅਸੀਂ ਸਾਰੇ ਘਰ ਦੀ ਧੋਆ ਧੁਆਈ ਕਰਕੇ ਸਫਾਈ ਕਰਕੇ ਸੈਟਿੰਗ ਕਰਕੇ ਜੋ ਸਮਾਨ ਦੇਣ ਵਾਲਾ ਸੀ ਉਹ ਸਾਰਾ ਅਸੀਂ ਬੋਰੀਆਂ ਦੇ ਵਿੱਚ ਪਾ ਕੇ ਇੱਕ ਪਾਸੇ ਲਗਾ ਦਿੱਤਾ ਸੀ ਜੋ ਕਿ ਕੂੜਾ ਚੁੱਕਣ ਵਾਲਾ ਆਵੇ ਤਾਂ ਉਸ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਉਹ ਵੀ ਆਰਾਮ ਦੇ ਨਾਲ ਚੁੱਕ ਕੇ ਇਸਦਾ ਨਿਪਟਾਰਾ ਕਰ ਲਵੇ ਕਿਉਂਕਿ ਹਰ ਇੱਕ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਦੂਜੇ ਨੂੰ ਵੀ ਉਸ ਨਾਲ ਮਦਦ ਮਿਲ ਸਕਦੀ ਹੈ ਸਾਡੇ ਸਾਰਿਆਂ ਨੇ ਘਰ ਦੇ ਵਿੱਚ ਸਾਰਿਆਂ ਨੇ ਰਲ ਕੇ ਮੇਰੇ ਨਾਲ ਹੈਲਪ ਕਰਵਾਈ ਮੇਰੇ ਨਾਲ ਹੈਲਪ ਕਰਵਾਉਣ ਨਾਲ ਉਹਨਾਂ ਨੇ ਮੇਰੇ ਨਾਲ ਘਰ ਨੂੰ ਸ਼ਿੰਗਾਰ ਕੇ ਸਾਰਾ ਵਧੀਆ ਢੰਗ ਨਾਲ ਸਜਾ ਕੇ ਸਾਰਾ ਮੇਰੇ ਨਾਲ ਕੂੜਾ ਇਕੱਠਾ ਕਰਵਾਇਆ ਕਿਉਂਕਿ ਸਾਡੇ ਇਸ ਘਰ ਨਾਲ ਕੂੜੇ ਵਾਲੇ ਨੂੰ ਵੀ ਬਹੁਤ ਮਦਦ ਮਿਲ ਗਈ ਜਿਸ ਵਿੱਚ ਉਸ ਦਾ ਵੀ ਟਾਈਮ ਵੇਸਟ ਨਾ ਹੋਇਆ ਉਹ ਆਇਆ ਅਤੇ ਉਸਨੇ ਜਲਦੀ ਜਲਦੀ ਸਾਰਾ ਫਰਨੀਚਰ ਸਾਰਾ ਕੂੜਾ ਸਾਰਾ ਪੁਰਾਣਾ ਸਮਾਨ ਜੋ ਉਸ ਦੀ ਗੱਡੀ ਦੇ ਵਿੱਚ ਰੱਖਣ ਵਾਲਾ ਸੀ ਉਹਨੇ ਫਟਾਫਟ ਨਿਪਟਾ ਲਿਆ ਤਾਂ ਕਿ ਉਹ ਵੀ ਆਪਣਾ ਕੰਮ ਟਾਈਮ ਸਿਰ ਕਰ ਸਕਿਆ